ਜੇਕਰ ਆਰਟਿਸਟ ਦੀ ਗੱਲ ਕੀਤੀ ਜਾਏ ਤਾਂ ਅੱਜ ਕੱਲ੍ਹ ਤਾਂ ਹਰ ਚੀਜ਼ ਕੋਈ ਵੀ ਅਸੀਂ ਕੋਈ ਸ਼ੂਟਿੰਗ ਕਰਨੀ ਹੋਵੇ ਜਾਂ ਕੁਛ ਕਰਨੀ ਹੋ ਉਹ ਸਾਰਾ ਕੁਛ ਗੌਰਮੈਂਟ ਥਰੂ ਸਾਨੂੰ ਕੀਤਾ ਜਾਂਦਾ ਜਿਸ ਕਰਕੇ ਸਾਨੂੰ ਕੋਈ ਤੰਗੀ ਨਹੀਂ ਆਉਂਦੀ ਯੂਟੀਊਬ ਵਿੱਚ ਅਸੀਂ ਕੋਈ ਸਟੋਰੀ ਦੇਣੀ ਹੋਏ ਜਾਂ ਕੁਛ ਕਰਨਾ ਸੈਂਪਲਿੰਗ ਕਰਨੀ ਹੋਵੇ ਤਾਂ ਅੱਜ ਕੱਲ੍ਹ ਸਾਨੂੰ ਗੌਰਮੈਂਟ ਵੱਲੋਂ ਪੂਰੀ ਛੂਟ ਦਿੱਤੀ ਜਾ ਰਹੀ ਹੈ ਜਿਸ ਕਰਕੇ ਉਹਨਾਂ ਨੂੰ ਗਵਰਮੈਂਟ ਵੱਲੋਂ ਨੂੰ ਕਹਿ ਕੇ ਅਸੀਂ ਉਹਨਾਂ ਕੋਲੋਂ ਹਰ ਚੀਜ਼ ਦੀ ਮਨਜ਼ੂਰੀ ਲੈ ਸਕਦੇ ਹਾਂ ਤਾਂ ਜੋ ਕਿ ਅਸੀਂ ਅੱਗੇ ਜਾ ਕੇ ਆਪਣੀ ਕੋਈ ਵੀ ਕੋਈ ਐਗਰੀਮੈਂਟ ਕਰਨਾ ਕੋਈ ਕੁਛ ਕਰਨ ਲਾਈਸੈਂਸਿੰਗ ਕਰਨਾ ਅਸੀਂ ਸਾਰਾ ਕੁਛ ਉਹਨਾਂ ਥਰੂ ਉਹਨਾਂ ਨੂੰ ਪੁੱਛ ਕੇ ਉਹਨਾਂ ਦੇ ਸਬੰਧੀ ਵਿੱਚ ਕਰ ਸਕਦੇ ਹਾਂ ਕੋਈ ਵੀ ਅਸੀਂ ਕਿਸੀ ਚੀਜ਼ ਦੀ ਵੀ ਮਸ਼ਹੂਰੀ ਦੇਣੀ ਹੋਏ ਜਾਂ ਅਸੀਂ ਕਿਸੇ ਚੀਜ਼ ਬਾਰੇ ਕੋਈ ਦੱਸਣਾ ਹੋਵੇ ਅੱਜ ਕੱਲ੍ਹ ਤਾਂ ਹਰ ਚੀਜ਼ ਲਈ ਸਾਨੂੰ ਕੋਈ ਨਾ ਕੋਈ ਮਸ਼ਹੂਰੀ ਅਸੀਂ ਦੇ ਸਕਦੇ ਹਾਂ ਹਰ ਤਰ੍ਹਾਂ ਦੀ ਗੌਰਮੈਂਟ ਕੋਲੋਂ ਮਨਜ਼ੂਰੀ ਲੈ ਸਕਦੇ ਹਾਂ ਤਾਂ ਜੋ ਕਿ ਸਾਨੂੰ ਆਉਣ ਵਾਲੇ ਸਮੇਂ ਵਿੱਚ ਕੋਈ ਵੀ ਮੁਸ਼ਕਿਲ ਨਹੀਂ ਹੋਏਗੀ ਅਸੀਂ ਕੋਈ ਛੋਟਾ ਜਿਹਾ ਸੈਂਪਲ ਕਿਸੇ ਨੂੰ ਦੇਣਾ ਹੋਵੇ ਦੱਸਣਾ ਹੋਵੇ ਜਾਂ ਅਸੀਂ ਤੁਸੀਂ ਕੋਈ ਆਰਟ ਬਾਰੇ ਜਾਂ ਕਿਸੇ ਦੀ ਕਿਸੀ ਵੀ ਐਗਰੀਮੈਂਟ ਬਾਰੇ ਅਸੀਂ ਗੱਲ ਕਰਨੀ ਹੋਏ ਅਸੀਂ ਉਸ ਦਾ ਪਹਿਲਾ ਲਾਈਸੈਂਸ ਤਿਆਰ ਕਰਵਾ ਕੇ ਅਸੀਂ ਉਸ ਬਾਰੇ ਹਰ ਗੱਲ ਕਰ ਸਕਦੇ ਹਾਂ ਅੱਜ ਕੱਲ੍ਹ ਕਾਪੀ ਰਾਈਟ ਵੀ ਬਹੁਤ ਚੱਲ ਰਿਹਾ ਇਸ ਕਰਕੇ ਕੋਈ ਇੱਕ ਦੂਜੇ ਨੂੰ ਦੇਖ ਕੇ ਵੀ ਅੱਜ ਕੱਲ੍ਹ ਕੰਮ ਕਰ ਰਹੇ ਨੇ ਸੋ